ਹਾਂ ਹੈਲੋ ਵੀਰਪਲ ਕਿਵੇਂ ਹੋ ਤੁਸੀਂ ਮੈਨੂੰ ਤੁਹਾਡਾ ਕੱਲ ਹੀ ਮੈਸੇਜ ਆ ਗਿਆ ਸੀ ਤੁਸੀਂ ਇਥੇ ਨਵੇਂ ਸ਼ਿਫਟ ਹੋ ਰਹੇ ਹੋ ਵੈਲਕਮ ਇਨ ਮਾਈ ਹੋਮ ਟਾਊਨ ਹਾਂਜੀ ਹਾਂਜੀ ਪਹਿਲਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਜਰੂਰ ਤੁਹਾਡੀ ਹੈਲਪ ਕਰਾਂਗੀ ਤੁਸੀਂ ਦੱਸੋ ਤੁਸੀਂ ਕਿਹੜੇ ਕਿਹੜੇ ਚੀਜ਼ ਬਾਰੇ ਇਨਕੁਇਰੀ ਕਰਨੀ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੀ ਇਥੇ ਲੋਕਲ ਮਾਰਕੀਟ ਆ ਫੂਡ ਐਂਡ ਵੈਜੀਟੇਬਲ ਮਾਰਕੀਟ ਜਿਥੇ ਆਹ ਜਿੱਥੇ ਵੈਜੀਟੇਬਲ ਦੀ ਮੰਡੀ ਹੈਗੀ ਆ ਇੱਥੇ ਹੀ ਬਿਲਕੁਲ ਆਪਾਂ ਨੂੰ ਸਸਤੇ ਤੇ ਵਧੀਆ ਔਰਗੈਨਿਕ ਆਈਟਮ ਮਿਲ ਜਾਂਦੀਆਂ ਨੇ ਇਥੇ ਜਿੰਨੀਆਂ ਵੀ ਆਸੇ ਪਾਸੇ ਦੇ ਪਿੰਡਾਂ ਦੀਆਂ ਫਰੈਸ਼ ਵੈਜੀਟੇਬਲ ਆਉਂਦੀਆਂ ਨੇ ਸਾਰੀਆਂ ਇਥੇ ਸੈਲ ਹੁੰਦੀਆਂ ਨੇ ਤੁਸੀਂ ਇਥੇ ਜਾ ਕੇ ਦੇਖ ਸਕਦੇ ਹੋ ਇਹ ਬਿਲਕੁਲ ਬਾਂਸੀ ਗੇਟ ਦੇ ਬਿਲਕੁਲ ਸਿੱਧੇ ਤੁਸੀਂ ਜਾਣਾ ਹੈ ਅਤੇ ਜਿੱਥੇ ਸਬਜ਼ੀ ਮੰਡੀ ਆ ਉੱਥੇ ਤੁਹਾਨੂੰ ਇਹ ਮਿਲ ਜਾਊਗਾ ਫਰੂਟ ਦਾ ਵੀ ਸੇਮ ਇਥੇ ਹੀ ਆ ਜਿੰਨੇ ਵੀ ਲੋਕਲ ਫਰੂਟ ਹੈਗੇ ਆ ਇਵਨ ਕਿ ਜਿਹੜੇ ਬਾਹਰੋਂ ਵੀ ਆਉਂਦੇ ਆ ਸਾਰਿਆਂ ਦੀ ਮਾਰਕੀਟਿੰਗ ਇੱਥੇ ਹੀ ਆ ਤੁਹਾਨੂੰ ਬਹੁਤ ਕੁਆਲਿਟੀ ਵਧੀਆ ਕੁਆਲਿਟੀ 'ਚ ਮਿਲ ਜਾਣਗੀਆਂ ਚੀਜ਼ਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਨੇੜੇ ਨੇੜੇ ਆ ਤੁਹਾਨੂੰ ਤੁਹਾਡਾ ਜਿਹੜਾ ਤੁਸੀਂ ਆਪਣਾ ਅਪਾਰਟਮੈਂਟ ਚੂਜ ਕੀਤਾ ਤੁਸੀਂ ਬਹੁਤ ਵਧੀਆ ਕੀਤਾ ਤੁਹਾਡੇ ਨਾਲ ਇੱਕ ਤਾਂ ਜਿਹੜੀ ਸਬਜ਼ੀ ਮੰਡੀ ਉਹ ਵੀ ਤੁਹਾਡੇ ਨੇੜੇ ਹੋ ਗਈ ਦੂਜਾ ਤੁਹਾਡਾ ਹੋਸਪਿਟਲ ਜਿਹੜਾ ਬਾਕੀ ਹੋਸਪਿਟਲ ਦਾ ਸਿਸਟਮ ਉਹ ਵੀ ਬਹੁਤ ਵਧੀਆ ਹੋ ਗਿਆ ਸੈਕਿੰਡਲੀ ਤੁਹਾਨੂੰ ਇੱਕ ਦੱਸਾਂ ਜਿਹੜੀ 'ਚ ਮਾਰਕੀਟ ਆ ਜਿੱਥੋਂ ਤੁਸੀਂ ਬਹੁਤ ਸਾਰੇ ਸ਼ੋਪਿੰਗ ਕਰ ਸਕਦੇ ਹੋ ਉਹ ਵੀ ਤੁਹਾਡੇ ਬਿਲਕੁਲ ਨੇੜੇ ਆ ਤੁਸੀਂ ਸੈਂਟਰ 'ਚ ਕੀਤਾ ਬਹੁਤ ਵਧੀਆ ਪਲੇਸ ਆ ਹਾਂਜੀ ਜੇ ਮਤਲਬ ਜਿਵੇਂ ਤੁਸੀਂ ਗਰੋਸਰੀ ਵਗੈਰਾ ਲੈਣੀ ਹੋਏ ਤਾਂ ਤੁਸੀਂ ਸਬਜ਼ੀ ਮੰਡੀ ਤੱਕ ਹੀ ਚਲੇ ਜਾਓਗੇ ਬਹੁਤ ਵਧੀਆ ਤੁਹਾਡੇ ਰਹਿ ਜਾਏਗਾ ਸੈਕਿੰਡਲੀ ਜੇ ਤੁਸੀਂ ਆਪਣਾ ਜਿੱਦਾਂ ਕਲੋਥ ਵਗੈਰਾ ਕੁਛ ਲੈਣੇ ਆ ਹੈ ਨਾ ਜਾਂ ਤੁਸੀਂ ਲੈਣੇ ਆ ਤਾਂ ਤੁਸੀਂ ਇਹਦੇ ਲਈ ਐਦਾ ਕਰਨਾ ਜਿਹੜੀ ਵਿਸ਼ਾਲ ਮੈਗਾਮਟ ਅਤੇ ਮਾਰਕੀਟ ਤੋਂ ਲੈ ਕੇ ਮਾਲਵਾ ਰੋਡ 'ਤੇ ਜਿੰਨੀ ਮਾਰਕੀਟ ਆ ਸਾਰੀ ਬਹੁਤ ਬੈਸਟ ਹੈ ਇਹ ਚੀਜ਼ਾਂ ਲਈ ਤੁਸੀਂ ਚਾਹੇ ਬਰੈਂਡਡ ਚੀਜ਼ਾਂ ਲੈਣੀਆਂ ਨੇ ਚਾਹੇ ਤੁਸੀਂ ਲੋਕਲ ਚੀਜ਼ਾਂ ਲੈਣੀਆਂ ਹੈ ਨਾ ਜਿੱਦਾਂ ਜਿੱਦਾਂ ਵੀ ਤੁਹਾਨੂੰ ਲੱਗੇ ਚੀਜ਼ ਪ੍ਰਾਈਜ਼ ਅਤੇ ਐਕਸਪੈਂਸਿਵ ਇੱਥੇ ਹਰੇਕ ਤਰ੍ਹਾਂ ਦੇ ਮਿਲ ਜਾਂਦੀਆਂ ਨੇ ਸੈਕਿੰਡਲੀ ਤੁਹਾਨੂੰ ਇੱਥੇ ਹਾਂਜੀ ਇੱਥੇ ਜਿਹੜੇ ਤੁਹਾਨੂੰ ਦੱਸ ਰਹੀ ਸੀ ਤੁਸੀਂ ਸ਼ੋਪਿੰਗ ਦੇ ਟਾਈਮ 'ਤੇ ਤੁਸੀਂ ਕੁਝ ਖਾਣਾ ਚਾਹੁੰਦੇ ਤਾਂ ਇੱਥੇ ਬਹੁਤ ਸਾਰੇ ਆਊਟਲੈਟਸ ਹੈਗੇ ਆ ਜਿੱਥੋਂ ਰੈਸਟੋਰੈਂਟ 'ਤੇ ਬੜਾ ਵਧੀਆ ਐਨ ਪੂਰਾ ਬਹੁਤ ਵਧੀਆ ਡਿਲੇਸ਼ੀਅਸ ਫੂਡ ਮਿਲਦਾ ਤੁਸੀਂ ਜ਼ਰੂਰ ਟਰਾਈ ਕਰਨਾ ਜਦੋਂ ਵੀ ਤੁਸੀਂ ਸ਼ੋਪਿੰਗ 'ਤੇ ਗਏ

ਨਹੀਂ ਨਹੀਂ ਤੁਸੀਂ ਇਹਦੇ ਲਈ ਕਿਤੇ ਆਊਟ ਜਾਣ ਦੀ ਲੋੜ ਨਹੀਂ ਆ ਮਨਜੀਤ ਟਾਵਰਜ਼ ਦੇ ਬਿਲਕੁਲ ਮੁਹਰੇ ਇੱਕ ਹੈਗੀ ਆ ਫਰਨੀਚਰ ਦੀ ਦਖਾ ਦੁਕਾਨ ਆ ਉਥੋਂ ਆਪਾਂ ਲੈ ਸਕਦੇ ਆ ਨਾਮਦੇਵ ਚੌਕ ਕੋਲ ਆਸਾਨੀ ਨਾਲ ਹਰੇਕ ਤਰ੍ਹਾਂ ਦਾ ਫਰਨੀਚਰ ਮਿਲ ਸਕਦਾ ਜੇ ਤੁਸੀਂ ਕੱਲ੍ਹ ਜਾ ਨੈਕਸਟ ਆਉਣ ਵਾਲੇ ਦਿਨਾਂ ਤੱਕ ਜਦੋਂ ਵੀ ਬਾਏ ਕਰਨਾ ਤੁਸੀਂ ਮੈਨੂੰ ਇੱਕ ਦਿਨ ਪਹਿਲਾਂ ਇਨਫੋਰਮ ਕਰ ਦੇਗਾ ਮੈਂ ਤੁਹਾਡੇ ਨਾਲ ਜ਼ਰੂਰ ਜਾਵਾਂਗੀ ਤੁਹਾਡੀ ਹੈਲਪ ਹੋਜੂਗੀ ਇਹਦੇ ਨਾਲ

ਆਈ ਥਿੰਕ ਆਲਮੋਸਟ ਇਥੇ ਮਿਲ ਤਾਂ ਜਾਊਗੀ ਪਰ ਤੁਸੀਂ ਇੱਕ ਵਾਰੀ ਇਹਦੇ ਲਈ ਆਪਾਂ ਵਿਸ਼ਾਲ ਮੈਗਾਮਾਟ ਵਿਜਿਟ ਕਰ ਲਵਾਂਗੇ ਬਾਕੀ ਇਥੇ ਇੰਨੀ ਵਰਾਇਟੀ ਨਹੀਂ ਤੁਹਾਨੂੰ ਮਿਲੂਗੀ ਬਟ ਅਕੋਰਡਿੰਗ ਟੂ ਤੁਹਾਡੇ ਹੋਮ ਅਤੇ ਬਜਟ ਦੇ ਅਕੋਡਿੰਗ ਤੁਹਾਨੂੰ ਵਧੀਆ ਮਿਲੂਗਾ ਹਾਂਜੀ ਹੋਰ ਹਾਂਜੀ ਹਾਂਜੀ ਤੁਸੀਂ

ਹਾਂਜੀ ਹਾਂਜੀ ਤੁਸੀਂ ਸੰਡੇ ਸੰਡੇ ਨੂੰ ਫਰੀ ਰੱਖੋ ਮੈਂ ਸੰਡੇ ਨੂੰ ਤੁਹਾਡੇ ਨਾਲ ਜ਼ਰੂਰ ਜਾਊਗੀ ਸੰਡੇ ਦਾ ਤੁਸੀਂ ਡਨ ਕਰ ਲਓ ਆਪਾਂ ਜ਼ਰੂਰ ਵਿਜਿਟ ਕਰਾਂਗੇ ਠੀਕ ਹੈ ਥੈਂਕ ਯੂ ਸੋ ਮਚ ਜੀ